ਜਿਸ ਤਰ੍ਹਾਂ ਮੇਰਾ ਕਾਰੋਬਾਰੀ ਵਿਸ਼ਾ ਇੱਕ ਜਗ੍ਹਾ 'ਤੇ ਮੈਂ ਸਕੂਲ ਦੇ ਵਿੱਚ ਕੰਮ ਕਰਦਾ ਹਾਂ ਪੀਅਨ ਦੇ ਤੌਰ 'ਤੇ ਇਸ ਦੇ ਵਿੱਚ ਬਹੁਤ ਹੀ ਸੰਘਰਸ਼ ਕਰਨੇ ਪੈਂਦੇ ਹਨ ਕਿਉਂਕਿ ਤੁਹਾਨੂੰ ਕੋਈ ਵੀ ਬੰਦਾ ਇੱਕ ਅਧਿਆਪਕ ਦੀ ਨਜ਼ਰ ਨਾਲ ਨਹੀਂ ਦੇਖਦਾ ਇੱਕ ਇੱਕ ਰਿਸਪੈਕਟ ਦੀ ਨਜ਼ਰ ਦੇ ਨਾਲ ਨਹੀਂ ਦੇਖਦਾ ਜਦੋਂ ਸਾਨੂੰ ਪਹਿਲੇ ਪਹਿਲੇ ਤਾਂ ਹੱਥ ਦੇ ਨਾਲ ਲੱਗੀ ਹੋਈ ਘੰਟੀ ਨੂੰ ਲੱਕੜ ਦੇ ਨਾਲ ਵਜਾਉਣਾ ਪੈਂਦਾ ਸੀ ਅਤੇ ਕਦੇ ਕਦੇ ਉਸ ਵਿੱਚ ਬਹੁਤ ਸੰਘਰਸ਼ ਕਰਨਾ ਪੈਂਦਾ ਸੀ ਕਿ ਜੋ ਸ਼ਰਾਰਤੀ ਬੱਚੇ ਸਕੂਲ ਦੇ ਵਿੱਚ ਹੁੰਦੇ ਸਨ ਉਹ ਪੀਰੀਅਡ ਦੇ ਹੋਣ ਤੋਂ ਪਹਿਲਾਂ ਹੀ ਉਸ ਨੂੰ ਵਜਾ ਦਿੰਦੇ ਸਨ ਅੱਜ ਦੀ ਵਿੱਚ ਸਕੂਲਾਂ ਦੇ ਅੱਗੇ ਵਧਣ ਦੇ ਨਾਲ ਜੋ ਵੀ ਤਕਨੀਕ ਨਵੀਂ ਆ ਗਈ ਹੈ ਉਸ ਦੇ ਕਾਰਨ ਬਹੁਤ ਹੀ ਆਸਾਨੀ ਹੋ ਗਈ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਸਾਨੂੰ ਹੱਥ ਦੇ ਨਾਲ ਬੈਲ ਨੂੰ ਵਜਾਉਣਾ ਨਹੀਂ ਪੈਂਦਾ ਇੱਕ ਸਇਰਨ ਦੇ ਤੌਰ 'ਤੇ ਜਾਂ ਬੈਲ ਦੇ ਤੌਰ 'ਤੇ ਇੱਕ ਗੀਤ ਦੇ ਤੌਰ 'ਤੇ ਜਾਂ ਉਸ ਨੂੰ ਇੱਕ ਹਰ ਇੱਕ ਸਕੂਲ ਦਾ ਆਪਣਾ ਆਪਣਾ ਜੋ ਵੀ ਬੈਲ ਦਾ ਵਜਾਉਣ ਦਾ ਤਰੀਕਾ ਹੁੰਦਾ ਹੈ ਉਸ ਨੂੰ ਵਜਾਇਆ ਜਾ ਸਕਦਾ ਹੈ ਜੋ ਕਿ ਪਹਿਲੇ ਦੇ ਜ਼ਮਾਨੇ ਦੇ ਵਿੱਚ ਨਹੀਂ ਸੀ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਬਹੁਤ ਹੀ ਆਸਾਨ ਹੋ ਗਿਆ ਹੈ ਅਤੇ ਇਸ ਦੇ ਵਿੱਚ ਅੱਜ ਵੀ ਬਹੁਤ ਸੰਘਰਸ਼ ਹਨ ਜੋ ਕਿ ਤੁਹਾਨੂੰ ਇੱਕ ਬਹੁਤ ਚੰਗੀ ਨਜ਼ਰ ਦੇ ਨਾਲ ਨਹੀਂ ਦੇਖਿਆ ਜਾਂਦਾ ਧੰਨਵਾਦ